ਅਸੀਂ ਉੱਚਾ ਪਿੰਡ ਸੰਘੋਲ ਗਏ ਉੱਥੇ ਇੱਕ ਪੁਰਾਤਨ ਅਜਾਇਬ ਘਰ ਹੈ ਉੱਥੇ ਪੁਰਾਣੇ ਅਵਸ਼ੇਸ਼ ਪ੍ਰਾਪਤ ਹੋਏ ਹਨ ਅਤੇ ਜੋ ਕਿ ਭਾਰਤ ਸਰਕਾਰ ਨੇ ਚੰਗੀ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ ਕੀਤੀ ਹੋਈ ਹੈ ਅਤੇ ਹੋਰ ਵੀ ਬਹੁਤ ਸਾਰੇ ਪੁਰਾਤਨ ਬਰਤਨ ਅਤੇ ਹੋਰ ਚੀਜ਼ਾਂ ਪੁਰਾਣੀਆਂ ਦੇਖਣ ਨੂੰ ਮਿਲੀਆਂ ਹਨ ਇਸ ਇਸ ਤੋਂ ਇਲਾਵਾ ਅਸੀਂ ਗੌਰਮੈਂਟ ਕੋਲਜ ਆਫ ਆਰਟਸ ਚੰਡੀਗੜ੍ਹ ਵੀ ਦੇਖ ਸਕਦੇ ਹਾਂ